ਸ਼ੋਸ਼ਲ ਮੀਡੀਆ ਪਲੈਟਫੋਮ ਨੇ ਲੋਕਾਂ ਨੂੰ ਕਲਾ ਅਤੇ ਸ਼ਿਲਪਕਾਰੀ ਵਿੱਚ ਸ਼ਾਮਲ ਹੋਣ ਵਿੱਚ ਬਹੁਤ ਮਦਦ ਕੀਤੀ ਹੈ ਸ਼ੋਸ਼ਲ ਮੀਡੀਆ ਦੀ ਸਹਾਇਤਾ ਨਾਲ ਅਸੀਂ ਕੋਈ ਵੀ ਚੀਜ਼ ਸਿੱਖ ਸਕਦੇ ਹਾਂ ਇਹ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਹੈ ਨਾਲ ਹੀ ਮੈਂ ਸ਼ੋਸ਼ਲ ਮੀਡੀਆ ਪਲੈਟਫਾਰਮ ਤੋਂ ਕਲਾ ਅਤੇ ਸ਼ਿਲਪਕਾਰੀ ਦੀ ਸਿੱਖਿਆ ਲਿੱਤੀ ਹੈ ਯੂਟੀਊਬ 'ਤੇ ਕਈ ਆਰਟ ਐਂਡ ਕਰਾਫਟ ਦੇ ਚੈਨਲ ਹਨ ਮੈਂ ਫਾਈਵ ਮਿੰਟ ਕਰਾਫ ਅਤੇ ਕਰਾਫਟ ਕਲਾਸਿਸ ਤੋਂ ਕਰਾਫਟ ਦੀ ਸਿੱਖਿਆ ਲਿੱਤੀ ਹੈ